ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਪੰਜਾਬ 'ਚ ਹਰ ਸਕੂਲ ਵਿੱਚ ਪੰਜਾਬੀ ਨੂੰ ਅਨਿਵਾਰਿਆ ਕਰਨਾ ਚਾਹੀਦਾ ਹੈ ਜਿਵੇਂ ਕਿ ਅਸੀਂ ਦੇਖ ਰਹੇ ਹਨ ਕਿ ਅੰਗਰੇਜ਼ੀ ਹਰ ਸਕੂਲ ਵਿੱਚ ਅਨਿਵਾਰਿਆ ਕੀਤੀ ਜਾ ਰਹੀ ਹੈ ਉਸੀ ਤਰ੍ਹਾਂ ਹੀ ਸਾਨੂੰ ਪੰਜਾਬੀ ਨੂੰ ਵੀ ਅਨਿਵਾਰਿਆ ਰੱਖਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਪੰਜਾਬੀ ਨੂੰ ਜ਼ਿਆਦਾ ਮਹੱਤਵ ਦੇਵੇ ਨਾ ਕਿ ਅੰਗਰੇਜ਼ੀ ਭਾਸ਼ਾ ਨੂੰ ਇਸੇ ਤਰ੍ਹਾਂ ਹੀ ਉਹਨੂੰ ਪ੍ਰਕਾਸ਼ਿਤ ਰੱਖਣ ਲਈ ਅਤੇ ਉਤਸ਼ਾਹਿਤ ਰੱਖਣ ਲਈ ਅਸੀਂ ਪੰਜਾਬੀ ਸ਼ ਭਾਸ਼ਾ ਦੇ ਕਈ ਕੰਪਟੀਸ਼ਨ ਵੀ ਰੱਖ ਸਕਦੇ ਹਨ ਜਿਹਦੇ ਉੱਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾ ਸਕਦੇ ਹਨ ਜੇਕਰ ਉਹ ਕਿਸ ਕੰਪਟੀਸ਼ਨ ਵਿੱਚ ਵਧੀਆ ਤੋਂ ਵਧੀਆ ਨੰਬਰ ਲਾਣਗੇ ਤਾਂ ਉਹਨਾਂ ਨੂੰ ਇੱਕ ਚੰਗਾ ਇਨਾਮ ਵੀ ਦਿੱਤਾ ਜਾਵੇਗਾ ਇਸ ਤਰ੍ਹਾਂ ਬੱਚਿਆਂ ਉਤਸ਼ਾਹਿਤ ਹੋਵੇਗਾ ਪੰਜਾਬੀ ਪੜ੍ਹਨ ਨੂੰ ਅਤੇ ਪੰਜਾਬੀ ਸਿੱਖਣ ਨੂੰ